ਹਾਂ ਜਗਜੀਤੇ ਕੀ ਹਾਲ ਹੈ ਬਸ ਠੀਕ ਹੈ ਅੱਜ ਕੱਲ੍ਹ ਤੂੰ ਦਿਖਦਾ ਨਹੀਂ ਫਸਲਾਂ ਹਰੀ ਕ੍ਰਾਂਤੀ ਜਿਹੜੀ ਆਈ ਹੈ ਉਹਨੇ ਫਸਲਾਂ 'ਤੇ ਕੀ ਅਸਰ ਪਾਇਆ ਵੈ ਅਤੇ ਫ਼ਸਲਾਂ ਦੀ ਪੈਦਾਵਾਰ ਚੰਗੀ ਹੋ ਗਈ ਹੈ ਅਤੇ ਪੈਦਾਵਾਰ ਜਿਹੜੀ ਚਾਵਲ ਦੀ ਖੇਤੀ ਕਿਸ ਤਰ੍ਹਾਂ ਦੀ ਹੋਈ ਹੈ ਅਤੇ ਗਰੀਬਾਂ ਦਾ ਕੁਝ ਸੁਧਾਰ ਹੋਵੇਗਾ ਠੀਕ ਹੈ ਅਤੇ ਅੱਗੋਂ ਅੱਗੋਂ ਹੋਰ ਸਰਕਾਰ ਕੀ ਕਰ ਰਹੀ ਹੈ ਫਸਲਾਂ ਦੀ ਪੈਦਾਵਾਰ ਵੀ ਹੁਣ ਪਾਣੀ ਕਾਰਨ ਚੰਗੀ ਹੋ ਜਾਵੇਗੀ ਚੱਲ ਠੀਕ ਆ ਫਿਰ ਹਾਂ ਚੰਗੀ ਗੱਲ ਹੈ ਕਿਸਾਨ ਨੇ ਕਿਸਾ ਸਰਕਾਰ ਨੇ ਕਿਸਾਨਾਂ ਬਾਰੇ ਸੋਚਿਆ ਚ ਚੰਗਾ ਹੀ ਸੋਚਿਆ ਕਿਸਾਨਾਂ ਦਾ ਹੋਰ ਸੁਣਾ ਅਨਾਜ ਦੀ ਅਨਾਜ ਦੀ ਪੈਦਾਵਾਰ ਦਾ ਕੀ ਹਾਲ ਹੈ ਮੇਰੀ ਫਸਲਾਂ ਤਾਂ ਠੀਕ ਹੁੰਦੀਆਂ ਪਈਆਂ ਵੈ ਅਨਾਜ ਵੀ ਚੰਗਾ ਨਿਕਲ ਰਿਹਾ ਅਨਾਜ ਦੇ ਬੀਜ ਵੀ ਉੱਚੇ ਉੱਚੇ ਆ ਰਹੇ ਆ ਹੁਣ ਬਸ ਕੱਟਣ ਦਾ ਵੇਲਾ ਆਏਗਾ ਤਾਂ ਫਿਰ ਦੇਖਾਂਗੇ ਕਿੰਨੀ ਕੁ ਪੈਦਾ ਹੋਈ ਹੈ ਕਿਸਾਨਾਂ ਨੂੰ ਕੀ ਲਾਭ ਹੋਇਆ